ਨਵੀਨਤਮ ਚੜ੍ਹਨ ਦੀਆਂ ਤਕਨੀਕਾਂ ਅਤੇ ਗੇਅਰ ਬਾਰੇ ਅਪ ਟੂ ਡੇਟ ਰਹਿਣ ਲਈ ਮੈਂ ਬਹੁਤ ਸਾਰੇ ਤਕ ਤਰੀਕਿਆਂ ਦੀ ਵਰਤੋਂ ਕਰਦਾ ਹਾਂ ਮੈਂ ਆਨਲਾਈਨ ਲੇਖਾਂ ਅਤੇ ਵੀਡੀਓਜ਼ ਨੂੰ ਪੜ੍ਹਦਾ ਹਾਂ ਚੜ੍ਹਨ ਵਾਲੇ ਭਾਈਚਾਰਿਆਂ ਨਾਲ ਜੁੜਦਾ ਹਾਂ ਅਤੇ ਤਜਰਬੇਕਾਰ ਚੜਾਈਆਂ ਨਾਲ ਗੱਲ ਕਰਦਾ ਹਾਂ ਮੈਂ ਨਵੀਨਤਮ ਗੇਅਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਨਿਰਮਾਤਾਵਾਂ ਦੀਆਂ ਵੈਬਸਾਈਟਾਂ ਅਤੇ ਸਮੀਖਿਆਵਾਂ 'ਤੇ ਵੀ ਜਾਂਦਾ ਹਾਂ ਹਾਲਾਂਕਿ ਮੇਰੇ ਕੋਲ ਕੋਈ ਰਸਮੀ ਕੋਚ ਜਾਂ ਸੰਸਥਾ ਨਹੀਂ ਹੈ ਜਿੱਥੇ ਮੈਂ ਸਿੱਖਿਆ ਪ੍ਰਾਪਤ ਕੀਤੀ ਹੈ ਮੈਂ ਹਮੇਸ਼ਾ ਸਿੱਖਣ ਅਤੇ ਆਪਣੇ ਹੁਨਰ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਮੰਨਦਾ ਹਾਂ ਕਿ ਤਜਰਬਾ ਅਤੇ ਸਵੈ ਸਿੱਖਿਆ ਚੜ੍ਹਾਈ ਵਿੱਚ ਸਫਲਤਾ ਦੀ ਕੁੰਜੀ ਹੈ